ਬਚਪਨ ਤੋਂ ਹੀ ਮੈਂ ਘੁੰਮਣ ਫਿਰਨ ਦਾ ਕਾਫ਼ੀ ਸ਼ੁਕੀਨ ਰਿਹਾ ਇਸ ਕਰਕੇ ਮੈਨੂੰ ਬਾਈਕਿੰਗ 'ਤੇ ਸਫ਼ਰ ਕਰਨਾ ਬਹੁਤ ਪਸੰਦ ਹੈ ਮੈਂ ਜਦੋਂ ਵੀ ਕਿਤੇ ਦੂਰ ਜਾਣਾ ਹੋਵੇ ਜਾਂ ਨੇੜੇ ਜਾਣਾ ਹੋਵੇ ਮੈਂ ਬਾਈਕ 'ਤੇ ਸਫ਼ਰ ਕਰਨਾ ਹੀ ਪਰੈਫੇਰ ਕਰਦਾ ਹਾਂ ਵੈਸੇ ਮੈਂ ਸਵੇਰੇ ਮੋਰਨਿੰਗ ਵਾਕ ਲਈ ਵੀ ਜਾਂਦਾ ਹਾਂ ਕਈ ਵਾਰ ਮੈਂ ਸਾਈਕਲਿੰਗ ਵੀ ਕਰਦਾ ਹਾਂ ਸਾਈਕਲਿੰਗ ਵੀ ਮੇਰੇ ਲਈ ਬੜੀ ਹੈਲਦੀ ਸਾਬਿਤ ਹੋ ਰਹੀ ਹੈ ਵਿੱਚ ਨੂੰ ਮੇਰਾ ਕਾਫ਼ੀ ਵਜ਼ਨ ਬਦਲਣ ਲੱਗ ਗਿਆ ਸੀ ਸਾਈਕਲਿੰਗ ਕਰਨ ਦੇ ਨਾਲ ਮੇਰਾ ਵਜ਼ਨ ਕੰਟਰੋਲ ਦੇ ਵਿੱਚ ਹੈ ਮੈਂ ਵਧੀਆ ਡਾਇਟ ਲੈਂਦਾ ਹਾਂ ਸੜਕਾਂ 'ਤੇ ਚੱਲਦੇ ਸਮੇਂ ਭੋਜਨ ਰੇਹੜੀ ਦਾ ਨਹੀਂ ਖਾਣਾ ਚਾਹੀਦਾ ਮੇਰੇ ਹਿਸਾਬ ਨਾਲ ਚੰਗਾ ਭੋਜਨ ਹੀ ਖਾਣਾ ਚਾਹੀਦਾ ਹਲਕਾ ਫੁਲਕਾ ਖਾਣਾ ਖਾਓ ਜਿਸ ਨਾਲ ਤੁਹਾਨੂੰ ਸੁਸਤੀ ਵੀ ਨਹੀਂ ਪੈਂਦੀ ਅਤੇ ਚੁ ਤੁਸੀਂ ਚੁਸਤ ਰਹਿੰਦੇ ਹੋ ਅਲੱਗ ਅਲੱਗ ਜਗ੍ਹਾ 'ਤੇ ਜਾ ਜਾ ਕੇ ਤੁਸੀਂ ਅਲੱਗ ਅਲੱਗ ਤਰ੍ਹਾਂ ਦੀਆਂ ਚੀਜ਼ਾਂ ਟਰਾਈ ਕਰਦੇ ਹੋ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਜਿਹੜਾ ਫੂਡ ਤੁਸੀਂ ਰੋਡ 'ਤੇ ਖਾਣਾ ਹੈ ਉਹ ਹੈਲਦੀ ਤੋਂ ਹੈਲਦੀ ਹੋਵੇ ਤੁਹਾਡੀ ਸਿਹਤ ਨੂੰ ਖਰਾਬ ਨਾ ਕਰੇ ਤੁਹਾਡਾ ਕੈਲਸਟਰੋਲ ਨਾ ਵਧਾਵੇ ਅਤੇ ਤੁਹਾਨੂੰ ਫਿਟ ਰੱਖੇ ਕਈ ਵੈਸੇ ਤਾਂ ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਸੜਕਾਂ 'ਤੇ ਮਿਲਣ ਵਾਲਾ ਭੋਜਨ ਜੰਕ ਫੂਡ ਜਾਂ ਫਾਸਟ ਫੂਡ ਹੀ ਹੁੰਦਾ ਹੈ ਜਿਹੜਾ ਤੁਹਾਡੀ ਸਿਹਤ ਨੂੰ ਅਨੇਕਾਂ ਤਰੀਕਿਆਂ ਨਾਲ ਖਰਾਬ ਕਰਦਾ ਹੈ ਤੁਹਾਡਾ ਵਜ਼ਨ ਵਧਾਉਂਦਾ ਹੈ ਤੁਹਾਨੂੰ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਸੜਕਾਂ 'ਤੇ ਜੇਕਰ ਭੋਜਨ ਕਰਨਾ ਵੀ ਹੈ ਤਾਂ ਹੈਲਦੀ ਕਰਨਾ ਚਾਹੀਦਾ ਹੈ ਜੂਸ ਵਗੈਰਾ ਪੀ ਲੈਣਾ ਚਾਹੀਦਾ ਹੈ ਜਾਂ ਕੋਈ ਸ਼ੇਕ ਵਗੈਰਾ ਪੀ ਲੈਣਾ ਚਾਹੀਦਾ ਹੈ ਆਮ ਤੌਰ 'ਤੇ ਜਦੋਂ ਬਾਈਕਿੰਗ 'ਤੇ ਜਾ ਜਾਣਾ ਹੈ ਤਾਂ ਹੈਲਮੇਟ ਕੋਲ ਚੁੱਕਣਾ ਚਾਹੀਦਾ ਜੋ ਤੁਹਾਡੀ ਸੇਫਟੀ ਲਈ ਜ਼ਰੂਰੀ ਹੈ ਅੱਖਾਂ 'ਤੇ ਗੋਗਲਸ ਵੀ ਲਗਾਉਣੀਆਂ ਚਾਹੀਦੀਆਂ ਤਾਂ ਜੋ ਤੁਸੀਂ ਧਿਆਨ ਨਾਲ ਆਪਣੀ ਬਾਈਕ ਚਲਾ ਸਕੋ ਮੱਛਰ ਵਗੈਰਾ ਦਾ ਤੁਹਾਨੂੰ ਖਤਰਾ ਨਾ ਹੋਵੇ ਹੋਰ ਵੀ ਕਈ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ ਬਾਈਕ ਚਲਾਉਂਦੇ ਸਮੇਂ ਜੇਕਰ ਤੁਸੀਂ ਥੱਕੇ ਹੋਏ ਹੋ ਅਨੀਂਦੇ ਹੋ ਤਾਂ ਤੁਸੀਂ ਸਫ਼ਰ ਤੋਂ ਪਰਹੇਜ ਕਰੋ ਜਿੰਨਾ ਕੁ ਸਫ਼ਰ ਤੁਹਾਡੀ ਸਿਹਤ ਕਰ ਸਕਦੀ ਹੈ ਜਿੰਨੀ ਦੇਰ ਤੁਸੀਂ ਕੰਫਰਟੇਬਲਲੀ ਬੈਠ ਸਕਦੇ ਹੋ ਉੰਨੀ ਕੁ ਦੇਰ ਹੀ ਤੁਹਾਨੂੰ ਬਾਈਕ 'ਤੇ ਸਫ਼ਰ ਕਰਨਾ ਚਾਹੀਦਾ ਹੈ